ਹੈਲੋ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਸਾਡੇ ਕੋਲ ਵੁੱਡਲੈਂਡ ਮਿਲ ਜਾਏਗਾ ਤੁਹਾਨੂੰ ਨਾਈਕੀ ਮਿਲ ਜਾਏਗਾ ਐਡੀਡਾਸ ਮਿਲ ਜਾਏਗਾ ਜਾਂ ਮੋਚੀ ਮਿਲ ਜਾਏਗਾ ਭਾਅ ਜੀ ਐਡੀਡਾਸ ਦੀ ਰੇਂਜ ਸਟਾਰਟ ਹੁੰਦੀ ਆ ਕੋਈ ਅੱਠ ਜਾਂ ਨੌਂ ਹਜ਼ਾਰ ਤੋਂ ਇਹਦੇ ਵਿੱਚ ਨਾ ਹੋਲੀ ਡਿਸਕਾਊਂਟ ਚੱਲਣ ਰਿਹਾ ਜੇ ਤਾਂ ਤੁਸੀਂ ਐਪ ਤੋਂ ਮੰਗਾਉਂਦੇ ਹੋ ਹੋਲੀ ਡਿਸਕਾਊਂਟ 'ਤੇ ਤੁਹਾਨੂੰ ਕੋਈ ਪੰਤਾਲੀ ਸੌ ਪੰਜ ਹਜ਼ਾਰ ਦਾ ਪੈ ਜਾਏਗਾ ਐਪ ਦੇ ਉੱਤੋਂ ਤੁਸੀਂ ਉੱਥੋਂ ਮੰਗਵਾ ਸਕਦੇ ਹੋ ਡਿਲੀਵਰੀ ਵੀ ਹੋ ਜਾਏਗੀ ਤੁਹਾਨੂੰ ਐਪ ਦੇ ਤੋਂ ਅੱਜ ਕੱਲ੍ਹ ਐਮਾਜੋਨ ਤੋਂ ਮੰਗਾ ਲਓ ਤੁਸੀਂ ਉਹ ਅਤੇ ਉਹ ਵੀ ਬੈਸਟ ਮਿਲ ਜਾਏਗਾ ਤੁਹਾਨੂੰ ਨਾਲੇ ਔਫਰ ਹੋਰ ਮਿਲ ਜਾਏਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਓਕੇ ਬਾਏ ਜੀ